ਹਾਂਜੀ ਬਲਦੇਵ ਕਿਵੇਂ ਹੋ ਬਸ ਵਧੀਆ ਅੱਛਾ ਹੋਰ ਕੀ ਕਰਦੇ ਅੱਜ ਕੱਲ੍ਹ ਉਹ ਵੈਰੀ ਗੁਡ ਕਿੱਥੇ ਚਲੋ ਸਹੀ ਆ ਸਹੀ ਆ ਮੈਂ ਵੀ ਕੋਈ ਪਾਰਟ ਟਾਈਮ ਜੋਬ ਦੇਖ ਰਿਹਾ ਸੀ ਉਸ ਤੋਂ ਬਾਅਦ ਮੈਨੂੰ ਤੇਰਾ ਚੇਤਾ ਆਇਆ ਮੈਂ ਕਿਹਾ ਬਿਨੀ ਦੇ ਨਾਲ ਮੇਰਾ ਕਾਫੀ ਵਧੀਆ ਅੱਗੇ ਵੀ ਬਿਜ਼ਨਸ ਪਾਰਟਨਰ ਮੇਰੀ ਰਹੀ ਆ ਵਧੀਆ ਚੱਲਦਾ ਰਿਹਾ ਆਪਣਾ ਅਤੇ ਉਹ ਕੋਵਿਡ ਕਰਕੇ ਥੋੜ੍ਹਾ ਜਿਹਾ ਬਸ ਖਰਾਬ ਹੋਇਆ ਸੀ ਅਤੇ ਕਿਉਂ ਨਾ ਆਪਾਂ ਦੁਬਾਰਾ ਕਰੀਏ ਯਾਰ ਸੈਟਅਪ ਕੀ ਹੋਇਆ ਆਪਣੇ ਕੋਲ ਇਨਫਰਾਸਟਰਕਚਰ ਸਾਰਾ ਕੁਛ ਉਹੀ ਪਿਆ ਆ ਆਪਾਂ ਬਸ ਸ਼ੁਰੂ ਹੀ ਕਰਨਾ ਆ ਮੈਨੂੰ ਸਟੂਡੈਂਟਸ ਦੀ ਕਾਫੀ ਕੋਲ ਆਉਂਦੀ ਹੈ ਕਿ ਸਰ ਕਰਨੀ ਟਿਊਸ਼ਨਸ ਅਤੇ ਮੈਂ ਕਿਹਾ ਚਲੋ ਕੰਮ ਤੋਂ ਹੀ ਨਹੀਂ ਵੇਹਲ ਹੁੰਦੀ ਹਾਂਜੀ ਹਾਂਜੀ ਚਲੋ ਕੋਈ ਨਹੀਂ ਆਪਾਂ ਕਰੀਏ ਸੈਟਅਪ ਤੂੰ ਇੱਕ ਵਾਰੀ ਘਰ ਗੱਲ ਕਰ ਅਤੇ ਜੋਬ ਦਾ ਫਿਰ ਦੇ ਦੇ ਰਿਜਾਇਨ ਅਤੇ ਆਪਾਂ ਫਿਰ ਮੰਡੇ ਤੋਂ ਸ਼ੁਰੂ ਕਰ ਦਿੰਦੇ ਕਮਿੰਗ ਮੰਡੇ ਤੋਂ ਹੀ ਹਾਂ ਹਾਂ ਹਾਂ ਹਾਂ ਹਾਂ ਸਹੀ ਆ ਹੋਰ ਸਭ ਠੀਕ ਠਾਕ ਆ ਚਲ ਤੂੰ ਇੱਕ ਵਾਰੀ ਘਰ ਸਲਾਹ ਕਰਕੇ ਮੈਨੂੰ ਦੱਸੀਂ ਅਤੇ ਫਿਰ ਆਪਾਂ ਸ਼ੁਰੂ ਕਰਦੇ ਹਾਂ